ਹੈਲੋ ਮੈਂ ਕਸਟਮਰ ਗੱਲ ਕਰ ਰਹੀ ਐਂ ਮੈਂ ਸਵਿਗੀ ਰਾਹੀਂ ਇੱਕ ਔਡਰ ਕੀਤਾ ਸੀ ਅਤੇ ਮੈਂ ਆਹ ਜਾਣਕਾਰੀ ਲੈਣਾ ਚਾਹੁੰਦੀ ਹਾਂ ਕਿ ਮੇਰਾ ਔਡਰ ਹਾਲੇ ਤੱਕ ਮਿਲਿਆ ਕਿਉਂ ਨਹੀਂ ਮੈਂ ਕੱਦੀ ਵੇਟ ਕਰ ਰਹੀ ਹੈ ਅਤੇ ਭੁੱਖੀ ਬੈਠੀ ਹਾਂ ਮੈਂ ਔਡਰ 'ਚ ਸਿਰਫ਼ ਔਰ ਸਿਰਫ਼ ਦੋ ਪੀਜ਼ਾ ਅਤੇ ਇੱਕ ਬਰਗਰ ਔਡਰ ਕੀਤੇ ਸੀ ਅਤੇ ਮੇਰਾ ਐਡਰੈੱਸ ਗਰੀਨ ਐਵਨਿਊ ਕਾਲਾਨੀ ਰੋਪੜ ਰਾਹੀਂ ਹੈ ਮੈਂ ਆਹ ਜਾਣਨਾ ਚਾਹੁੰਦੀ ਹੈ ਕਿ ਜਿਹੜਾ ਮੇਰਾ ਰਾਈਡਰ ਹੈ ਨਾ ਹੀ ਮੇਰਾ ਫੋਨ ਚੁੱਕ ਰਿਹਾ ਅਤੇ ਨਾ ਹੀ ਮੇਰੇ ਔਡਰ ਦੀ ਜਾਣਕਾਰੀ ਮੈਨੂੰ ਪ੍ਰਾਪਤ ਹੋ ਰਹੀ ਹੈ ਮੈਨੂੰ ਆਹਾ ਦੱਸ ਦੋ ਕਿ ਮੇਰਾ ਔਡਰ ਲੇਟ ਕੀ ਹੋਇਆ ਨਾਲੇ ਕਦ ਤੱਕ ਪਹੁੰਚਣ ਦੀ ਤੁਸੀਂ ਕ੍ਰਿਪਾਲਤਾ ਕਰੋਂਗੇ ਨਾਲੇ ਮੇਰਾ ਔਡਰ ਮੈਂ ਚਾਹੁੰਦੀ ਹਾਂ ਕਿ ਮੇਰੇ ਪੁਰਾਣੇ ਐਡਰੈੱਸ 'ਤੇ ਹੀ ਸਮੇਂ ਵਿੱਚ ਪਹੁੰਚਿਆ ਜਾਵੇ ਮੈਂ ਚਾਹੁੰਦੀ ਹਾਂ ਕਿ ਮੇਰਾ ਔਡਰ ਛੇਤੀ ਤੋਂ ਛੇਤੀ ਮੈਨੂੰ ਪਹੁੰਚਾਇਆ ਜਾਵੇ ਧੰਨਵਾਦ